ਪੰਜਾਬ ਦੀਆਂ ਰਿਵਾਇਤਾਂ ਸ਼ੈਲੀਆਂ ਅਤੇ ਆਰਕੀਟੈਕਚਰ ਅੱਜ ਵੀ ਪਿੰਡਾਂ ਵਿੱਚ ਸਾਨੂੰ ਕਿਤੇ ਨਾ ਕਿਤੇ ਦੇਖਣ ਨੂੰ ਮਿਲਦੀਆਂ ਹਨ ਪੰਜਾਬ ਦੇ ਕਈ ਪਿੰਡਾਂ ਵਿੱਚ ਘਰ ਕੱਚੇ ਹਨ ਜੋ ਕਿ ਮਿੱਟੀ ਦੇ ਨਾਲ ਲਿੱਪੇ ਜਾਂਦੇ ਆ ਕੰਧਾਂ ਦੇ ਉੱਤੇ ਕੁਛ ਇੱਦਾਂ ਦੀਆਂ ਕਲਾ ਕ੍ਰਿਤੀਆਂ ਬਣੀਆਂ ਹੁੰਦੀਆਂ ਹਨ ਜਿਨਾਂ ਨੂੰ ਅਸੀਂ ਦੇਖਦੇ ਹਾਂ ਅਤੇ ਗੁਰਦੁਆਰੇ ਮੰਦਿਰ ਕੁਛ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਕਿ ਪਹਿਲਾਂ ਵਰਗੇ ਨਹੀਂ ਹੈਗੇ ਪਹਿਲਾਂ ਬਹੁਤ ਜਾਣੀ ਕਿ ਸਾਰਾ ਕੁਛ ਕੱਚਾ ਹੀ ਹੁੰਦਾ ਹੁੰਦਾ ਸੀ ਥੱਲਿਓ ਵੀ ਮਿੱਟੀ ਦੇ ਪੋਚੇ ਫੇਰੇ ਜਾਂਦੇ ਹੁੰਦੇ ਸੀਗੇ ਕੋਈ ਫ ਫਰਸ਼ ਵਗੈਰਾ ਨਹੀਂ ਹੁੰਦਾ ਸੀ ਉੱਥੇ ਲੱਗਾ ਹੋਇਆ ਅਤੇ ਘਰ ਵੀ ਬਹੁਤ ਕੱਚੇ ਹੁੰਦੇ ਹੁੰਦੇ ਸਨ ਭਾਈਚਾਰਕ ਲੋਕਾਂ ਵਿੱਚ ਸਾਂਝ ਹੁੰਦੀ ਸੀ ਸਾਰੇ ਪਿੰਡਾਂ ਵਿੱਚ ਮਿਲ ਕੇ ਰਹਿੰਦੇ ਹੁੰਦੇ ਸੀਗੇ ਹੁਣ ਜਿਹੜੀ ਕਿ ਸਾਨੂੰ ਇਹ ਚੀਜ਼ ਦੇਖਣ ਨੂੰ ਨਹੀਂ ਮਿਲਦੀ ਫਿਰ ਆਪਾਂ ਹਰਿਮੰਦਰ ਸਾਹਿਬ ਦੀ ਵੀ ਗੱਲ ਕਰੀਏ ਤਾਂ ਉੱਥੇ ਆਲੇ ਦੁਆਲੇ ਪਾਣੀ ਆ ਸਰੋਵਰ ਬਹੁਤ ਵਧੀਆ ਬਣਿਆ ਹੋਇਆ ਆ ਅਤੇ ਸਾਰੇ ਗੁਰਦੁਆਰੇ 'ਚ ਝਾਲ਼ ਫੇਰੀ ਹੋਈ ਆ ਸੋਨੇ ਦੀ